ਅਗਸਤ ਦੇ ਮਹੀਨੇ ਮੇਰੇ ਮਾਮਾ ਜੀ ਦੇ ਬੇਟੇ ਦਾ ਜਨਮ ਦਿਨ ਸੀ ਸਾਡਾ ਸਾਰਾ ਪਰਿਵਾਰ ਉਸ ਦੇ ਜਨਮ ਦਿਨ 'ਤੇ ਚਲਾ ਗਿਆ ਮੈਂ ਇਕੱਲਾ ਹੀ ਘਰ ਸੀ ਕਿਉਂਕਿ ਘਰ ਸੁੰਨਾ ਛੱਡ ਕੇ ਨਹੀਂ ਸੀ ਜਾ ਸਕਦੇ ਕਿਉਂਕਿ ਸਾਡੇ ਘਰ ਪਸ਼ੂ ਰੱਖੇ ਹੋਏ ਸਨ ਅਤੇ ਮੈਂ ਉਹਨਾਂ ਦੀ ਦੇਖ ਭਾਲ ਲਈ ਘਰ ਹੀ ਰੁਕਿਆ ਸਾਂ ਰਾਤ ਨੂੰ ਮੈਂ ਖਾਣਾ ਵੀ ਖ਼ੁਦ ਹੀ ਪਕਾਉਣਾ ਸੀ ਮੈਂ ਸਬਜ਼ੀ ਕੱਟੀ ਅਤੇ ਸਬਜ਼ੀ ਨੂੰ ਤੜਕਾ ਲਾ ਕੇ ਸਿਲੰਡਰ 'ਤੇ ਧਰ ਦਿੱਤਾ ਮੈਂ ਖ਼ੁਦ ਆਟਾ ਗੁੰਨ੍ਹਣ ਲੱਗ ਪਿਆ ਮੈਂ ਆਟਾ ਗੁੰਨ੍ਹ ਕੇ ਰੱਖ ਦਿੱਤਾ ਪਰ ਸਬਜ਼ੀ ਅਜੇ ਤੱਕ ਬਣੀ ਨਹੀਂ ਸੀ ਮੈਨੂੰ ਫੋਨ ਆ ਗਿਆ ਫੋਨ ਸੁਣਦਾ ਸੁਣਦਾ ਮੈਂ ਸਬਜ਼ੀ ਬਾਰੇ ਭੁੱਲ ਹੀ ਗਿਆ ਜਦੋਂ ਰਸੋਈ ਵਿੱਚ ਵੜਿਆ ਤਾਂ ਸਬਜ਼ੀ ਸਾਰੀ ਮੱਚ ਗਈ ਸੀ ਹੁਣ ਮੇਰੇ ਕੋਲ ਰੋਟੀ ਖਾਣ ਲਈ ਕੁਝ ਵੀ ਨਹੀਂ ਸੀ ਇਸ ਲਈ ਮੈਂ ਦੁਕਾਨ 'ਤੇ ਗਿਆ ਅਤੇ ਉੱਥੋਂ ਦਹੀਂ ਦਾ ਪੈਕਟ ਲਿਆ ਅਤੇ ਉਸ ਵਿੱਚ ਨਮਕ ਅਤੇ ਮਿਰਚਾਂ ਮਿਲਾ ਕੇ ਰੋਟੀ ਖਾਧੀ